ਤਕਨਾਲੋਜੀ ਕਾਰਨ ਸਾਡੇ ਸਮਾਜ ਵਿੱਚ ਬਹੁਤ ਤਰੱਕੀ ਆਈ ਮੇ ਮੈਂ ਮੇਰੇ ਕੋਲ ਵੀ ਇੱਕ ਸਮਾਰਟਫੋਨ ਹੈ ਮੈਂ ਇੱਕ ਸਟੂਡੈਂਟ ਹਾਂ ਮੈਂ ਐਜੂਕੇਸ਼ਨ ਲਈ ਆਪਣਾ ਕੋਈ ਵੀ ਕੋਰਸ ਔਨਲਾਈਨ ਸਿਸਟਮ ਰਾਹੀਂ ਜਿਵੇਂ ਕੋਈ ਕੋਲਜ ਕਰ ਸਕਦੀ ਹਾਂ ਉਸ ਕੋਲਜ ਦੀ ਫੀਸ ਮੈਂ ਔਨਲਈਨ ਸਿਸਟਮ ਰਾਹੀਂ ਚੈੱਕ ਕਰ ਸਕਦੀ ਹਾਂ ਬੈਂਕ ਵਿੱਚ ਮੈਂ ਆਪਣਾ ਔਨਲਾਈਨ ਕੋਈ ਵੀ ਅਗਰ ਕੋਈ ਮੇਰੇ ਨਾਲ ਫਰੌਟ ਕਰ ਰਿਹਾ ਤਾਂ ਮੈਂ ਔਨਲਾਈਨ ਰਿਪੋਰਟ ਕਰ ਸਕਦੀ ਹਾਂ ਸ਼ੋ ਮੈਂ ਔਨਲਾਈਨ ਸ਼ੋਪਿੰਗ ਕਰ ਸਕਦੀ ਹਾਂ ਸ਼ੋਪਿੰਗ ਲਈ ਮੈਂ ਔ ਫਰਨੀਚਰ ਦਾ ਸਮਾਨ ਔਨਲਾਈਨ ਓਰਡਰ ਕਰ ਸਕਦੀ ਹਾਂ ਅਸੀਂ ਕੋਈ ਵੀ ਸੂਟ ਔਨਲਾਈਨ ਓਰਡਰ ਕਰ ਸਕਦੇ ਹਾਂ ਅਸੀਂ ਸਬਜ਼ੀਆਂ ਵੀ ਔਨਲਾਈਨ ਓਰਡਰ ਕਰਦੇ ਹਾਂ ਅਸੀਂ ਮੇਰੇ ਪਾਪਾ ਅਸੀਂ ਘੁੰਮਣ ਜਾਣਾ ਸੀ ਮੇਰੇ ਪਾਪਾ ਟਿਕਟ ਬੁੱਕ ਕਰਵਾਉਣ ਲਈ ਜਾ ਰਹੇ ਸੀ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਔਨਲਾਈਨ ਟਿਕਟ ਬੁੱਕ ਕਰ ਸਕਦੀ ਹਾਂ ਮੈਂ ਇਸ ਮੈਂ ਔਨਲਾਈਨ ਟਿਕਟ ਬੁੱਕ ਕਰੀ ਮੈਨੂੰ ਸਿੰਗਿੰਗ ਡਾਂਸਿੰਗ ਕੁਕਿੰਗ ਦਾ ਬਹੁਤ ਸ਼ੌਕ ਹੈ ਮੈਂ ਇਹ ਸਭ ਚੀਜ਼ਾਂ ਔਨਲਾਈਨ ਯੂਟੀਊਬ 'ਤੇ ਸਿੱਖ ਰਹੀ ਹਾਂ ਅਤੇ ਮੈਂ ਫਿਰੀ ਟਾਈਮ ਵਿੱਚ ਆਪਣਾ ਮਨੋਰੰਜਨ ਕਰਨ ਲਈ ਯੂਟੀਊਬ ਯੂਜ ਕਰਦੀ ਹਾਂ ਉਸ 'ਤੇ ਮੈਂ ਸੌਂਗ ਸੁਣ ਲੈਂਦੀ ਹਾਂ